ਸਾਡੇ ਪਿੰਡ ਵਿੱਚ ਇੱਕ ਨਹਿਰ ਵੱਗ ਵੱਗਦੀ ਹੈ ਜਿਹੜੀ ਕਿ ਬਿਆਸ ਨਹਿਰ ਹੈ ਉਹ ਸਾਰਾ ਸਾਲ ਵੱਗਦੀ ਹੈ ਅਤੇ ਇਸ ਤੋਂ ਇਲਾਵਾ ਸਾਡੇ ਪਿੰਡ ਵਿੱਚ ਸਮਰਸੀਬਲ ਬੋਰ ਲੱਗੇ ਹੋਏ ਨੇ ਜਿਹਨਾਂ ਦੇ ਵਿੱਚੋਂ ਜਿਹਨਾਂ ਦੇ ਵਿੱਚੋਂ ਸਾਰਾ ਸਾਲ ਪਾਣੀ ਆਉਂਦਾ ਹੈ ਅਤੇ ਇਹਨਾਂ ਮੋਟਰ ਇਹਨਾਂ ਦੇ ਵਿੱਚ ਮੋਟਰਾਂ ਰਾਹੀ ਪਾਣੀ ਕੱਢਿਆ ਜਾਂਦਾ ਹੈ ਅਤੇ ਇਹ ਸਾਨੂੰ ਪੂਰੇ ਸਾਲ ਪਾਣੀ ਉਪਲੱਬਧ ਕਰਵਾਉਂਦੇ ਹਨ ਇਸ ਤੋਂ ਇਲਾਵਾ ਸਾਡੇ ਉਹ ਸਾਨੂੰ ਕਮੇਟੀ ਵੱਲੋਂ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜਾ ਕਿ ਸਵੇਰੇ ਸਾਨੂੰ ਅੱਠ ਤੋਂ ਦਸ ਅਤੇ ਸ਼ਾਮ ਵੇਲੇ ਸਾਨੂੰ ਛੇ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਪਾਣੀ ਦੀ ਸਪਲਾਈ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਰਾਹੀਂ ਸਾਨੂੰ ਪਾਣੀ ਦਾ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਜਿਸ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਅਤੇ ਇਸ ਤੋਂ ਇਲਾਵਾ ਸਾਨੂੰ ਸਾਡੇ ਪਿੰਡ ਵਿੱਚ ਖੂਹ ਬਣੇ ਹੋਏ ਆ ਜਿਹੜੇ ਕਿ ਬਰਸਾਤਾਂ ਵਿੱਚ ਇੱਕ ਬਰਸਾਤਾਂ ਵਿੱਚ ਭਰ ਜਾਂਦੇ ਨੇ ਜਿਹਨਾਂ ਨਾਲ ਅਸੀਂ ਜਿਹੜਾ ਇਹ ਜਿਹਨਾਂ ਨਾਲ ਅਸੀਂ ਖੇਤੀ ਖੇਤੀ ਦੇ ਵਿੱਚ ਸਿੰਚਾਈ ਦਾ ਕੰਮ ਕਰਦੇ ਹਨ ਇਸ ਤੋਂ ਇਲਾਵਾ ਸਾਡੇ ਕੋਲ ਕਈ ਵਾਰ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਮਿਊਨਸੀਪਲ ਕਮੇਟੀ ਵੱਲੋਂ ਪਾਣੀ ਦੇ ਟੈਂਕਰ ਭੇਜੇ ਜਾਂਦੇ ਹਨ ਉਹਨਾਂ ਟੈਂਕਰਾਂ ਦੇ ਰਾਹੀਂ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ ਇਹ ਸਾਰੇ ਇਹਨਾਂ ਦੇ ਵਿੱਚੋਂ ਕੁਝ ਸਰੋ ਸਰੋਤ ਕੁਝ ਸਰੋਤ ਸਾਨੂੰ ਹਰਸ ਹਰ ਸਾਲ ਉਪਲੱਬਧ ਹੁੰਦੇ ਨੇ ਜਿਹਨਾਂ ਦੇ ਵਿੱਚੋਂ ਇੱਕ ਨਹਿਰ ਦਾ ਪਾਣੀ ਹੋ ਗਿਆ ਸ ਅਤੇ ਸਮਰਸੀਬਲ ਦਾ ਪਾਣੀ ਹੋ ਗਿਆ ਅਤੇ ਕੁਝ ਸਰੋਤ ਜਿਹੜੇ ਹੈਗੇ ਨੇ ਉਹ ਸਾਨੂੰ ਬਰਸਾਤਾਂ ਦੇ ਮੌਸਮ ਦੌਰਾਨ ਹੀ ਮਿਲਦੇ ਹਨ